ਭਾਰਤ ਵਿੱਚ ਬਹੁਤ ਸਾਰੀਆਂ ਨਾਚ ਸ਼ੈਲੀਆਂ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿੱਚ ਪ੍ਰਚਲਿਤ ਨੇ ਜਿਵੇਂ ਪੰਜਾਬ ਦੇ ਅੰਦਰ ਬੜੀ ਪ੍ਰਸਿੱਧ ਨਾਚ ਸ਼ੈਲੀ ਹੈ ਲੋਕ ਨਾਚ ਹੈ ਭੰਗੜਾ ਭੰਗੜਾ ਪੰਜਾਬੀਆਂ ਦੀ ਸੂਰਬੀਰਤਾ ਬਹਾਦਰੀ ਜਜ਼ਬੇ ਦਾ ਪ੍ਰਤੀਕ ਆ ਢੋਲ ਦੇ ਡਗੇ ਦੇ ਉੱਤੇ ਜਦੋਂ ਨੌਜਵਾਨ ਗੱਭਰੂ ਪੰਜਾਬ ਦੇ ਨੱਚਦੇ ਨੇ ਉਹ ਆਪਣੇ ਅੰਦਰ ਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਨੇ ਭੰਗੜਾ ਗਰੁੱਪ ਦੇ ਵਿੱਚ ਸਮੂਹਿਕ ਰੂਪ ਦੇ ਵਿੱਚ ਨੌਜਵਾਨ ਗੱਭਰੂ ਜਦੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਨੇ ਤਿਉਹਾਰਾਂ ਦੇ ਉੱਤੇ ਤਿਉਹਾਰਾਂ ਨੂੰ ਮਨਾਉਂਦਿਆਂ ਮੇਲਿਆਂ ਦੇ ਵਿੱਚ ਇਹਨਾਂ ਮੌਕਿਆਂ ਦੌਰਾਨ ਭੰਗੜੇ ਰਾਹੀਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਪੰਜਾਬ ਦੀ ਲੋਕ ਨਾਚ ਹੋਣ ਕਰਕੇ ਇਹਦੇ ਹੀ ਬੜੀ ਮਕਬੂਲਤਾ ਹੈ ਪੰਜਾਬ ਦੇ ਨੌਜਵਾਨ ਗੱਭਰੂ ਬੜੀ ਉਤਸ਼ਾਹ ਦੇ ਨਾਲ ਇਹਦੇ ਵਿੱਚ ਆਪਣਾ ਹਿੱਸਾ ਲੈਂਦੇ ਨੇ ਭੰਗੜਾ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਬਜ਼ੁਰਗਾਂ ਤੱਕਰ ਇਹਦੀ ਮਕਬੂਲਤਾ ਹੈ ਅਤੇ ਭਾਰਤ ਵਿੱਚ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਭੰਗੜੇ ਦੇ ਕਲਾਕਾਰ ਨੇ ਜਿਵੇਂ ਬਹੁਤ ਸਾਰੇ ਗਾਇਕ ਵੀ ਨੇ ਜਿਹੜੇ ਬਹੁਤ ਸੋਹਣੇ ਢੰਗ ਦੇ ਨਾਲ ਭੰਗੜਾ ਪਾਉਂਦੇ ਨੇ ਜਿਵੇਂ ਦਿਲਜੀਤ ਸਿੰਘ ਦੁਸਾਂਝ ਆ ਉਹਦਾ ਵੀ ਭੰਗੜਾ ਬਹੁਤ ਪਿਆਰਾ ਹੁੰਦਾ ਸੋ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਲੋਕ ਨਾਚ ਭੰਗੜਾ ਹੈ ਉਹਦੀ ਬਹੁਤ ਮਕਬੂਲਤਾ ਹੈ ਭੰਗੜੇ ਦੇ ਨਾਲ ਹੀ ਭੰਗੜਾ ਨੌਜਵਾਨਾਂ ਦਾ ਲੜਕਿਆਂ ਦਾ ਅਤੇ ਗਿੱਧਾ ਜਿਹੜਾ ਕੁੜੀਆਂ ਦਾ ਲੋਕ ਨਾਚ ਹੈ ਜਿਹੜਾ ਪੰਜਾਬ ਦੇ ਵਿੱਚ ਬਹੁਤ ਪ੍ਰਸਿੱਧ ਹੈ